ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅਸੀਂ ਕਲੱਬ ਚੋਂ ਬੋਲਦੇ ਹਾਂ ਜੀ ਹਾਂਜੀ ਹਾਂਜੀ ਇੱਥੇ ਡਾਂਸ ਹੈ ਨੈਟਵਾਲ ਆ ਫੁਟਬਾਲ ਆ ਕ੍ਰਿਕੇਟ ਆ ਸਭ ਗੇਮਾਂ ਨੇ ਜੀ ਹਾਂਜੀ ਹਾਂਜੀ ਕਰਾਟੇ ਵੀ ਨੇ ਹਾਂਜੀ ਹਾਂਜੀ ਜ਼ਰੂਰ ਪਾਓ ਜੀ ਹਾਂਜੀ ਤੁਹਾਡਾ ਕਿੰਨੇ ਬੱਚੇ ਨੇ ਜੀ ਠੀਕ ਹੈ ਜੀ ਲੜਕੇ ਜਾ ਲੜਕੀਆਂ ਨੇ ਜੀ ਕਿੰਨੇ ਸਾਲ ਦੇ ਨੇ ਜੀ ਹਾਂਜੀ ਅਤੇ ਤੁਸੀਂ ਹਾਂਜੀ ਲੜਕੀ ਹੈ ਜਿਹੜੀ ਤੁਸੀਂ ਉਹਨੂੰ ਜੇ ਕਰਾਟੇ ਬਿਲਕੁਲ ਸਿਖਾਓ ਜੀ ਉਹਨੂੰ ਕਰਾਟੇ ਸਿਖਾਓ ਕਿਉਂਕਿ ਆਪਣੀ ਸੁਰੱਖਿਆ ਕਰ ਸਕਦੀ ਆ ਕਿਸੇ ਚੀਜ਼ ਤੋਂ ਕਰਾਟੇ ਸਿੱਖਣੇ ਉਹਦੇ ਲਈ ਬਹੁਤ ਜ਼ਰੂਰੀ ਹੁੰਦੇ ਹਾਂਜੀ ਜੀ ਸਾਡੇ ਕੋਲ ਡਾਂਸ ਵਗੈਰਾ ਵੀ ਹੈਗਾ ਜੀ ਅਸੀਂ ਡਾਂਸ ਦੀ ਕਲਾਸਾਂ ਲੱਗਦੀਆਂ ਨੇ ਜੀ ਅਸੀਂ ਡਾਂਸ ਵੀ ਸਿਖਾ ਦਾਂਗੇ ਜੀ ਹਾਂਜੀ ਟਾਈਮਿੰਗ ਸੁਬਹ ਨੌਂ ਵਜੇ ਤੋਂ ਹੈ ਜੀ ਨੌਂ ਵਜੇ ਤੋਂ ਸ਼ਾਮ ਦੇ ਪੰਜ ਵਜੇ ਤੱਕ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਫੀਸ ਵਗੈਰਾ ਦੀ ਗੱਲ ਜੀ ਅਸੀਂ ਸੁਬਹ ਹੀ ਕਰਲਾਂ ਗੇ ਜੀ ਠੀਕ ਹੈ